ਮੇਰਾ ਸੈਕਿੰਡ ਪ੍ਰੋਡਕਟ ਜਿਹੜਾ ਸੀਗਾ ਉਹ ਕਿਚਨਵੇਅਰ 'ਤੇ ਸੀਗਾ ਜਿਹਦੇ 'ਚ ਮੈਂ ਨਾਈਫ ਔਡਰ ਕੀਤੇ ਸੀਗੇ ਐਮਾਜੋਨ ਤੋਂ ਵੈਸੇ ਐਮਾਜੋਨ ਦਾ ਮੈਂ ਕਾਫੀ ਨਾਮ ਸੁਣਿਆ ਸੀਗਾ ਅਤੇ ਮੇਰਾ ਮਤਲਬ ਜਿਹੜਾ ਸੀਗਾ ਉਹ ਪਹਿਲਾ ਐਕਸਪੀਰੀਅੰਸ ਸੀਗਾ ਕਿ ਮੈਂ ਉਹਨਾਂ ਕੋਲੋਂ ਔਡਰ ਕਰਦੀ ਸੀ ਪਰ ਮੈਨੂੰ ਕੋਈ ਖਾਸ ਸੈਟੀਫਿਕੇਸ਼ਨ ਨਹੀਂ ਮਿਲੀ ਇੱਕ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਟ ਵਿਲ ਬੀ ਅ ਸੈਟ ਅੋਫ ਫੋਰ ਕੇ ਬਈ ਫੋਰ ਦਾ ਸੈੱਟ ਹੋਊਗਾ ਫੋਰ ਦਾ ਸੈੱਟ ਹੋਊਗਾ ਅਤੇ ਲੇਕਿਨ ਉਹ ਜਿਹੜੇ ਸੀਗੇ ਉਹ ਫੋਰ ਦਾ ਸੈੱਟ ਨਹੀਂ ਸੀਗਾ ਉਹ ਸਿਰਫ ਟੂ ਦਾ ਸੈੱਟ ਸੀ ਅਤੇ ਨਾਲ ਟੂ ਉਹਨਾਂ ਨੇ ਮਤਲਬ ਉਹਨਾਂ ਦੇ ਕੁਛ ਛੋਟੇ ਮੋਟੇ ਜਿਹੇ ਨਾਲ ਲਗਾਏ ਹੋਏ ਸੀਗੇ ਪ੍ਰੋਪਰ ਨਾਈਫ ਨਹੀਂ ਆਪਾਂ ਉਹਨਾਂ ਨੂੰ ਕਹਿ ਸਕਦੇ ਅਤੇ ਜਿਹੜੀ ਉਹਨਾਂ ਦੇ ਨਾਈਫ ਦੀ ਕੁਆਲਿਟੀ ਉਹ ਬਹੁਤ ਜ਼ਿਆਦਾ ਖਰਾਬ ਸੀਗੀ ਅਤੇ ਉਹ ਕੋਈ ਸ਼ਾਪ ਵੀ ਨਹੀਂ ਸੀਗੇ ਕਿ ਤੁਸੀਂ ਉਹਨਾਂ ਨਾਲ ਪ੍ਰੋਪਰ ਚੀਜ਼ਾਂ ਜਿਹੜੀਆਂ ਕੱਟ ਸਕੋ ਈਵਨ ਉਹਨਾਂ ਨੇ ਕਿਹਾ ਸੀਗਾ ਕਿ ਉਹ ਜਿਹੜਾ ਬਟਲਰ ਨਾਈਫ ਵੀ ਇੱਕ ਨਾਲ ਆਪਾਂ ਦੇਵਾਂਗੇ ਪਰ ਉਹਦੇ 'ਚ ਉਹ ਵੀ ਜਿਹੜੀ ਹੈਗੀ ਸੀਗੀ ਅੋਪਸ਼ਨ ਉਹ ਇੰਕਲੂਡ ਨਹੀਂ ਹੈਗੀ ਸੀ ਅਤੇ ਮੈਨੂੰ ਮਤਲਬ ਬਿਲਕੁਲ ਵਧੀਆ ਨਹੀਂ ਲੱਗਾ ਕਿ ਵੀ ਉਹਨਾਂ ਨੇ ਜਿੱਦਾਂ ਦੇ ਮਤਲਬ ਭੇਜੇ ਹੈ ਉੱਤੋਂ ਉਹਦੀ ਪੈਕਿੰਗ ਸਾਰੀ ਖਰਾਬ ਹੋਈ ਹੋਈ ਸੀ ਜਿੰਨੀ ਦੇਰ ਤੱਕ ਉਹ ਮੇਰੇ ਘਰ ਪਹੁੰਚਿਆ ਓਨੀ ਦੇਰ ਤੱਕ ਉਹਦੇ ਸਾਰੇ ਮਤਲਬ ਉੱਪਰੋਂ ਦੀ ਬੋਕਸ ਵਗੈਰਾ ਬਰੋਕਨ ਸੀਗਾ ਅਤੇ ਬੜੀ ਮੈਨੂੰ ਮੁਸ਼ਕਲ ਹੋਈ ਆ ਮੈਂ ਚਾਹੁੰਦੀ ਹਾਂ ਕਿ ਜੇ ਹੋ ਸਕਦਾ ਤਾਂ ਮੇਰੇ ਜਿਹੜੇ ਪੈਸੇ ਨੇ ਉਹ ਰਿਫੰਡ ਕਰ ਦਿੱਤੇ ਜਾਣ ਮੈਂ ਸਾਢੇ ਛੇ ਸੌ ਰੁਪਇਆ ਨਾਈਫ ਉੱਤੇ ਲਗਾਇਆ ਸੀ ਮੈਨੂੰ ਲੱਗਾ ਸੀ ਕਿ ਕਾਫੀ ਵਧੀਆ ਹੋਏਗਾ ਜਿਵੇਂ ਸੈੱਟ ਵਗੈਰਾ ਸ਼ੋ ਕਰ ਰਹੇ ਸੀ ਲੇਕਿਨ ਉੱਦਾਂ ਦੀ ਜਿਹੜੀ ਆ ਉਹਨਾਂ ਨੇ ਕੋਈ ਚੀਜ਼ ਮਤਲਬ ਪ੍ਰੋਪਰ ਜਿਹੜੀ ਆ ਉਹ ਨਹੀਂ ਦਿੱਤੀ ਮੈਨੂੰ